ਨੌ ਲੱਖ ਅੱਠ ਹਜ਼ਾਰ ਚਾਰ ਸੌ ਤੀਹ ਸੱਤ ਲੱਖ ਸਤਾਨਵੇਂ ਹਜ਼ਾਰ ਨੌ ਸੌ ਬਿਆਸੀ ਛੇ ਲੱਖ ਦਸ ਹਜ਼ਾਰ ਅੱਠ ਸੌ ਉੱਨੀ ਤਿੰਨ ਲੱਖ ਪੰਨਤਾਲੀ ਹਜ਼ਾਰ ਪੰਜ ਸੌ ਸੋਲਾਂ ਦੋ ਲੱਖ ਸੰਨਤਾਲੀ ਹਜ਼ਾਰ ਚਾਰ ਸੌ ਪੰਜਾਹ